ਕਰੋਨਾ ਲੋਕਡਾਊਨ ਦੌਰਾਨ ਮੋਬਾਇਲ ਫੋਨ ਦੇ ਫ਼ਾਇਦੇ ਵੀ ਬਹੁਤ ਜ਼ਿਆਦਾ ਹੋਏ ਅਤੇ ਉਹਦੇ ਨੁਕਸਾਨ ਵੀ ਹੋਏ ਫ਼ਾਇਦੇ ਇੱਦਾਂ ਹੋਏ ਕਿ ਆਨਲਾਈਨ ਵੀਡੀਓ ਕਲੈਚਰ ਲੱਗੇ ਈ ਲਰਨਿੰਗ ਪਲੈਟਫਾਰਮ ਬਣਾਏ ਬੱਚੇ ਪੜ੍ਹਾਈ ਜਾਰੀ ਰੱਖ ਸਕੇ ਮੋਬਾਇਲ ਰਾਹੀਂ ਬੱਚਿਆਂ ਦੇ ਵੱਡੇ ਦੋਸਤ ਰਿਸ਼ਤੇਦਾਰ ਅਧਿਆਪਕ ਨਾਲ ਜੁੜੇ ਰਹੇ ਠੀਕ ਹੈ ਨਾ ਨਵੇਂ ਹੁਨਰ ਸਿੱਖਣ ਨੂੰ ਵੀ ਮਿਲੇ ਯੂਟੀਊਬ 'ਤੇ ਐਪਸ ਨਾਲ ਬੱਚਿਆਂ ਨੇ ਕੁਕਿੰਗ ਅ ਪੇਂਟਿੰਗ ਸਿੱਖੀ ਮਨੋਰੰਜਨ ਵੀ ਕੀਤਾ ਗੇਮਸ ਮੂਵੀਜ਼ ਗੀਤ ਆਡੀਓਜ ਅਤੇ ਲੋਕਾਂ ਨੇ ਬੋਰ ਹੋਣ ਤੋਂ ਵੀ ਬਚੇ ਠੀਕ ਹੈ ਮੋਬਾਈਲ ਰਾਹੀਂ ਘਰ ਬੈਠੇ ਜ਼ਰੂਰੀ ਸਮਾਨ ਜਿਵੇਂ ਕਿ ਦਵਾਈਆਂ ਮੰਗਵਾਉਣੀਆਂ ਰਾਸ਼ਨ ਮੰਗਵਾਉਣਾ ਸਾਰੀਆਂ ਚੀਜ਼ਾਂ ਮੰਗਵਾ ਸਕੇ ਠੀਕ ਆ ਨਾ ਇਸ ਤਰ੍ਹਾਂ ਨਾਲ ਇਹ ਫ਼ਾਇਦਾ ਹੋਇਆ ਕਿ ਬੱਚਿਆਂ ਦੀ ਪੜ੍ਹਾਈ ਅਤੇ ਪੜਾਈ ਦਾ ਨੁਕਸਾਨ ਨਹੀਂ ਹੋਇਆ ਅਤੇ ਬੱਚੇ ਆਪਣੇ ਟੀਚਰ ਦੇ ਨਾਲ ਵੀ ਇੰਟਰੈਕਟ ਰਹੇ ਠੀਕ ਆ ਨਾ ਅਤੇ ਬੱਚਿਆਂ ਦੇ ਪੇਪਰ ਵੀ ਆਨਲਾਈਨ ਦਿੱਤੇ ਈਵਨ ਕਰੋਨਾ ਟਾਈਮ 'ਚ ਬੱਚਿਆਂ ਨੇ ਪੇਪਰ ਵੀ ਆਨਲਾਈਨ ਦਿੱਤੇ ਪਰ ਇਹਦੇ ਇੱਕ ਜਦੋਂ ਕਰੋਨਾ ਗਿਆ ਉਸ ਤੋਂ ਬਾਅਦ ਇਹਦੇ ਨੁਕਸਾਨ ਬਹੁਤ ਜ਼ਿਆਦਾ ਹੋਏ ਬੱਚਿਆਂ ਦਾ ਜਿਹੜਾ ਮੋਬਾਈਲ ਵਰਤਣ ਦਾ ਟਾਈਮ ਨਾ ਬਹੁਤ ਜ਼ਿਆਦਾ ਵੱਧ ਗਿਆ ਠੀਕ ਹੈ ਨਾ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਉਹਨਾਂ ਦਾ ਦਿਮਾਗ 'ਤੇ ਫੈਕਟ ਪੈਣਾ ਸ਼ੁਰੂ ਹੋ ਗਿਆ ਠੀਕ ਆ ਬੱਚੇ ਅੱਗੇ ਪਿੱਛੇ ਖੇਡਣ ਜਾਂਦੇ ਸੀ ਹੁਣ ਸਾਰਾ ਦਿਨ ਮੋਬਾਇਲ 'ਤੇ ਲੱਗੇ ਰਹਿੰਦੇ ਹੈ ਜਿਸ ਨਾਲ ਉਹ ਆਪਣਾ ਟ ਸਮਾਂ ਬਰਬਾਦ ਵੀ ਕਰਦੇ ਆ ਕਈ ਬ ਕਈ ਐਂਵੀ ਮ ਮੋਬਾਇਲ ਗੇਮਾਂ ਖੇਲਣੀਆਂ ਸ਼ੁਰੂ ਕਰਤੀਆਂ ਪੈਸੇ ਵਾਲੀਆਂ ਗੇਮਾਂ ਖੇਲਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਨਾਲ ਸਾਰਾ ਕੰਮ ਖ਼ਰਾਬ ਹੋ ਗਿਆ ਔਨਲਾਈਨ ਗੇਮਾਂ ਦੇ ਨਾਲ ਆਨਲਾਈਨ ਨਸ਼ੇ ਵੀ ਖਰੀਦਣੇ ਸ਼ੁਰੂ ਕਰ ਦਿੱਤੇ ਠੀਕ ਹੈ ਨਾ ਫਾਇਰ ਫਰੱਗ ਪੱਬਜੀ ਗੇਮਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਕਈ ਬੱਚੇ ਇਹ ਗੇਮਾਂ ਖੇਲ੍ਹ ਕੇ ਮਰ ਵੀ ਗਏ ਠੀਕ ਹੈ ਨਾ ਅਤੇ ਇਹਦੇ ਕਾਰਨ ਇਹ ਹੋਇਆ ਕਿ ਲੋਕਡਾਊਨ ਬ ਬੱਚਿਆਂ ਦਾ ਸਿੱਖਿਆ ਅਤੇ ਸੰਚਾਰ ਅਤੇ ਮੰਨੋਰੰਜਣ 'ਤੇ ਹੋਇਆ ਪਰ ਇਹਦੇ ਨਾਲ ਕਈ ਸਮੱਸਿਆਵਾਂ ਇਵੇਂ ਹੀ ਖੜੀਆਂ ਹੋ ਗਈਆਂ ਠੀਕ ਆ ਬੱਚਿਆਂ ਨਕਲੀ ਜਾਣਕਾਰੀ ਵੀ ਅਫਵਾਵਾਂ ਵੀ ਬਹੁਤ ਜ਼ਿਆਦਾ ਇਹਦੇ ਨਾਲ ਠੱਗੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਲੋਕੀ ਅਫਵਾਵਾਂ ਫੈਲਾਣ ਲੱਗ ਪਏ ਗਲਤ ਖ਼ਬਰਾਂ ਦੇਣ ਲੱਗ ਪਏ ਇਹਦੇ ਨਾਲ ਇਹ ਵੀ ਹੋਇਆ ਬੱਚੇ ਸਾਰਾ ਦਿਨ ਪਬਜੀ ਫਾਇਰ ਫਰੀ ਫਾਇਰ ਵਰਗੀਆਂ ਗੇਮਾਂ ਦੀਆਂ ਆਦਤਾਂ ਬੱਚਿਆਂ ਨੂੰ ਪੈ ਗਈਆਂ ਜਿਹਦੇ ਨਾਲ ਉਹ ਪੜ੍ਹਾਈ ਦੇ ਸਮੇਂ ਬਰਬਾਦੀ ਉਹ ਹੋਈ ਨਸ਼ੇ ਵਰਗੀਆਂ ਆਦਤਾਂ ਵੀ ਪੈ ਗਈਆਂ ਸ ਮਾਂ ਅਤੇ ਬੱਚਿਆਂ ਨੂੰ ਵੱਧ ਬੱਚਿਆਂ ਦਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਬੱਚੇ ਸਕਰੀਨ ਟਾਈਮ ਬੱਚਿਆ ਦਾ ਇਸ ਵੱਧ ਗਿਆ ਬਹੁਤ ਹੀ ਜ਼ਿਆਦਾ ਵੱਧ ਗਿਆ ਜਿਹਦੇ ਨਾਲ ਨੁਕਸਾਨ ਹੋਇਆ